ਮੈਨੂੰ ਕਾਫੀ ਸਮੇਂ ਤੋਂ ਕੱਪੜੇ ਧੋਣ ਦੀ ਦਿੱਕਤ ਬਹੁਤ ਆ ਰਹੀ ਸੀ ਸਰਦੀਆਂ ਦੇ ਵਿੱਚ ਠੰਡੇ ਪਾਣੀ ਨਾਲ ਕੱਪੜੇ ਧੋਣੇ ਬੜੇ ਔਖੇ ਲੱਗ ਰਹੇ ਸੀ ਫਿਰ ਅਸੀਂ ਸੋਚਿਆ ਕਿਉਂ ਨਾ ਵਾਸ਼ਿੰਗ ਮਸ਼ੀਨ ਲੈ ਲਈ ਜਾਵੇ ਅਸੀਂ ਬਹੁਤ ਸਾਰੀਆਂ ਵਾਸ਼ਿੰਗ ਮਸ਼ੀਨਸ ਔਨਲਾਈਨ ਦੇਖੀਆਂ ਜਿਵੇਂ ਵਰਲਕੂਲ ਹੈ ਸੈਮਸੰਗ ਹੈ ਐੱਲ ਜੀ ਹੈ ਉਹਦੇ ਵਿੱਚੋਂ ਮੈਨੂੰ ਸਿਰਫ ਐੱਲ ਜੀ ਦੀ ਵਾਸ਼ਿੰਗ ਮਸ਼ੀਨ ਵਧੀਆ ਲੱਗੀ ਕਿਉਂਕਿ ਇੱਕ ਤਾਂ ਉਹ ਨਿਊ ਟੈਕਨੋਲਜੀ ਦੀ ਸੀ ਅਤੇ ਉਹਦੇ ਵਿੱਚ ਜਿਵੇਂ ਉਹਦੀ ਨੌ ਕਿਲੋ ਦੀ ਸੀ ਉਹਦੇ ਵਿੱਚ ਕੱਪੜੇ ਗਰਮ ਜਿਵੇਂ ਕਿ ਰਜਾਈਆਂ ਕੰਬਲ ਰਜਾਈਆਂ ਦੇ ਛਾੜ ਹੋਰ ਵੀ ਵੂਲਨ ਕੱਪੜੇ ਆਪਾਂ ਆਸਾਨੀ ਨਾਲ ਧੋ ਸਕਦੇ ਹਾਂ ਤਾਂ ਉਹਦੇ ਵਿੱਚ ਇੱਕ ਫੀਚਰ ਮੈਨੂੰ ਹੋਰ ਬਹੁਤ ਵਧੀਆ ਲੱਗਿਆ ਜਿਵੇਂ ਕਿ ਉਹ ਫੋਨ ਨਾਲ ਅਟੈਚ ਹੋ ਜਾਂਦੀ ਏ ਤਾਂ ਜੇ ਅਸੀਂ ਕਿਤੇ ਬਾਹਰ ਅੰਦਰ ਜਾਂਦੇ ਹਾਂ ਜਾਂ ਰਾਤ ਨੂੰ ਲੇਟ ਮੁੜਦੇ ਹਾਂ ਤਾਂ ਫੋਨ ਨਾਲ ਅਟੈਚ ਹੋਣ ਕਰਕੇ ਬਹੁਤ ਸੌਖਾ ਹੋ ਗਿਆ ਸੀ ਤਾਂ ਉਸਦੇ ਵਿੱਚ ਹੋਰ ਵੀ ਬਹੁਤ ਸਾਰੇ ਫੀਚਰਸ ਨੇ ਜਿਵੇਂ ਕਿ ਕੋਟਨ ਦੇ ਕੱਪੜੇ ਵੀ ਅਤੇ ਮਿਕਸਡ ਕੋਟਨ ਸਾਰੇ ਕੱਪੜੇ ਆਪਾਂ ਆਸਾਨੀ ਨਾਲ ਧੋ ਸਕਦੇ ਹਾਂ ਇਸ ਤੋਂ ਇਲਾਵਾ ਜਿਵੇਂ ਸਪੋਰਟਸ ਵੀਅਰ ਹੋ ਗਏ ਜਾਂ ਕਈ ਵਾਰ ਆਪਣੇ ਘਰ 'ਚ ਕੋਈ ਪੇਸ਼ੈਂਟ ਹੁੰਦਾ ਉਹਦੇ ਕੱਪੜੇ ਉਹ ਵੱਖਰੇ ਆ ਉਹਦੇ ਵਿੱਚ ਆਪਸ਼ਨ ਆ ਕੱਪੜੇ ਧੋਣ ਦੀ

ਤਾਂ ਆਪਾਂ ਥਰਟੀ ਤੀਹ ਮਿੰਟ ਦੇ ਵਿੱਚ ਹੀ ਆਪਣਾ ਕੰਮ ਕੱਪੜੇ ਧੋਣ ਦਾ ਕੰਮ ਨਿੱਬੜ ਜਾਂਦਾ ਅਤੇ ਸਾਰਾ ਦਿਨ ਅਰਾਮ ਰਹਿੰਦਾ ਤਾਂ ਇਹ ਮੈਨੂੰ ਆਪਸ਼ਨ ਸਭ ਤੋਂ ਵਧੀਆ ਲੱਗੀ ਜਿਹਦੇ ਕਰਕੇ ਮੈਨੂੰ ਐਲ ਜੀ ਦੀ ਫੁਲੀ ਮਸ਼ੀਨ ਲੈਣ ਦਾ ਬਹੁਤ ਫਾਇਦਾ ਹੋਇਆ ਅਤੇ ਮੇਰੀ ਲਾਈਫ ਬਹੁਤ ਸੌਖੀ ਹੋ ਗਈ ਅੱਗੇ ਨਾਲੋਂ ਇਹਦੇ ਵਿੱਚ ਇੱਕ ਹੋਰ ਆਪਸ਼ਨ ਵੀ ਵਧੀਆ ਜਿਵੇਂ ਕਿ ਟੱਬ ਵਾਸ਼ ਆਪਾਂ ਪੰਦਰਾਂ ਕੁ ਦਿਨਾਂ ਬਾਅਦ ਜਾਂ ਮਹੀਨੇ ਬਾਅਦ ਇਹਦਾ ਟੱਬ ਵੀ ਆਸਾਨੀ ਨਾਲ ਵਾਸ਼ ਕਰ ਸਕਦੇ ਹਾਂ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਅਤੇ ਇਸ ਦੇ ਲਾ ਇਲਾਵਾ ਹੁਣ ਵਾਸ਼ਿੰਗ ਮਸ਼ੀਨ ਆਉਣ ਦੇ ਨਾਲ ਮੈਨੂੰ ਇਨਾ ਸੌਖਾ ਹੋ ਗਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਬਾਕੀ ਕੰਮ ਬਹੁਤ ਆਸਾਨੀ ਨਾਲ ਅਤੇ ਕਰ ਸਕਦੀ ਏ ਅਤੇ ਸਮਾਂ ਵੀ ਮੈਨੂੰ ਬਹੁਤ ਮਿਲ ਜਾਂਦਾ ਬਾਕੀ ਕੰਮ ਕਰਨ ਦਾ ਪਹਿਲਾਂ ਮੈਨੂੰ ਕੱਪੜੇ ਧੋਣ 'ਤੇ ਬਹੁਤ ਸਮਾਂ ਲੱਗਦਾ ਸੀ ਪਰ ਹੁਣ ਲਾਈਫ ਬਹੁਤ ਆਸਾਨ ਹੋ ਗਈ ਏ